ਖੇਡਣਾ ਮੈਨੂੰ ਬਹੁਤ ਪਸੰਦ ਹੈ ਅਤੇ ਜਿਸ ਕਾਰਨ ਮਤਲਬ ਮੈਂ ਇੱਕ ਆਪ ਆਪਣਾ ਪਲੇਅਰ ਹਾਂ ਅਤੇ ਮੈਨੂੰ ਮੈਂ ਇੱਕ ਕ੍ਰਿਕਟ ਦਾ ਪਲੇਅਰ ਹਾਂ ਅਤੇ ਮੈਂ ਸਵੇਰੇ ਸਵੇਰੇ ਸਾਝਰੇ ਉੱਠ ਕੇ ਰਨਿੰਗ ਕਰਨ ਵੀ ਜਾਂਦਾ ਏ ਅਤੇ ਮਤਲਬ ਜੇਕਰ ਬੰਦੇ ਨੂੰ ਵਧੀਆ ਪਲੇਅਰ ਬਣਨਾ ਹੋਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਉਹਦਾ ਸਰੀਰ ਫਿਟ ਨਹੀਂ ਰਹੂੰਗਾ ਤਾਂ ਤਾਂ ਉਹ ਕੋਈ ਵੀ ਗੇਮ ਖੇਡ ਨਹੀਂ ਸਕਦਾ ਅਤੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਸਾਨੂੰ ਡਾਇਟ ਲੈਣੀ ਪੈਂਦੀ ਹੈ ਅਤੇ ਵਧੀਆ ਵਧੀਆ ਡਾਇਟ ਲੈਣੀ ਪੈਂਦੀ ਹੈ ਜਿਸ ਕਾਰਨ ਸਾਡਾ ਸਰੀਰ ਸਰੀਰ ਵਧੀਆ ਰਹਿੰਦਾ ਹੈ ਅਤੇ ਨਾਲੇ ਖੇਡਣ ਦੇ ਨਾਲ ਮੋਟਾਪਾ ਵੀ ਨਹੀਂ ਆਉਂਦਾ ਅਤੇ ਨਾਲੇ ਬੰਦਾ ਫਿਟ ਰਹਿੰਦਾ ਹੈ ਅਤੇ ਜ਼ਿਆਦਾ ਦੇਰ ਤੱਕ ਮਤਲਬ ਬੰਦਾ ਜੀ ਸਕਦਾ ਅਗਰ ਜੇਕਰ ਅਸੀਂ ਖੇਡਾਂ ਨਹੀਂ ਖੇਡਾਂਗੇ ਤਾਂ ਫਿਰ ਮਤਲਬ ਅਸੀਂ ਮੋਟਾਪੇ ਵਿੱਚ ਆ ਜਾਉਂਗੇ ਅਤੇ ਅਸੀਂ ਚੱਲਣ ਫਿਰਨ ਤੋਂ ਆਲਸੀ ਪਣ ਹੋ ਜੂੰਗੇ ਪਰ ਜੇਕਰ ਅਸੀਂ ਖੇਡਾਂ ਖੇਡਾਂਗੇ ਤਾਂ ਅਸੀਂ ਚੁਸਤ ਚਲਾਕ ਆਪਾਂ ਨਾਲੇ ਜ਼ਿਆਦਾ ਦੇਰ ਤੱਕ ਅਸੀਂ ਜੀ ਸਕਦੇ ਹਾਂ ਅਤੇ ਮਤਲਬ ਅਸੀਂ ਬਹੁਤ ਕੁਛ ਕਰ ਸਕਦੇ ਹਾਂ ਅਤੇ ਮਤਲਬ ਅਤੇ ਜਿੱਦਾਂ ਕਿ ਮਤਲਬ ਅਸੀਂ ਖੇਡਾਂ ਕੋਈ ਵੀ ਖੇਡ ਲਈਏ ਚਾਹੇ ਕੋਈ ਵੀ ਖੇਡ ਹੋਵੇ ਸਭ ਤੋਂ ਪਹਿਲੀ ਗੱਲ ਤਾਂ ਉਹਦੇ ਵਿੱਚ ਇਹ ਹੈ ਕਿ ਬੰਦੇ ਦਾ ਸਰੀਰ ਜੇਕਰ ਫਿਟ ਨਹੀਂ ਹੋਵੇਗਾ ਤਾਂ ਫਿਰ ਉਹ ਕੋਈ ਖੇਡ ਨਹੀਂ ਖੇਡ ਸਕੇਗਾ